ਅੱਜ ਸਾਡੇ ਰਸੋਈ ਦੇ ਵਿੱਚ ਤਕਰੀਬਨ ਏ ਟੂ ਜੈਡ ਜਿਹੜੇ ਅੱਜ ਦੀ ਸੁਵਿਧਾ ਵਾਲੇ ਉਪਕਰਨ ਨੇ ਉਹ ਸਾਰੇ ਹੀ ਮੌਜੂਦ ਨੇ ਜਿਵੇਂ ਮੈਕਰੋਵੇਵ ਹੋ ਗਿਆ ਉਹਦੇ ਨਾਲ ਹੀ ਓਵਨ ਤੱਕ ਵੀ ਰੱਖਿਆ ਅਤੇ ਮਸਾਲਾ ਵਗੈਰਾ ਰਗੜਨ ਲਈ ਮਿਕਸਰ ਗਰੈਂਡਰ ਹੋ ਗਿਆ ਅਤੇ ਪਹਿਲਾ ਕਿਆ ਸੀਗਾ ਬਾਹਰ ਰਸੋਈ ਬਾਹਰ ਹੁੰਦੀ ਸੀ ਉੱਥੇ ਚੁੱਲ੍ਹਾ ਜਲਦਾ ਹੁੰਦਾ ਸੀ ਚੁੱਲ੍ਹੇ ਦੇ ਵਿੱਚ ਜਿਵੇਂ ਡੱਕੇ ਚੁੱਕ ਕੇ ਲਿਆਉਣਾ ਕਈ ਵਾਰੀ ਆ ਪਾਥੀਆਂ ਪੱਥਣੀਆਂ ਉਹ ਚੱਲਦੀਆਂ ਤੀਆ ਪਰ ਅੱਜ ਕੱਲ੍ਹ ਤਾਂ ਸਿਲੰਡਰ ਆ ਗਏ ਗੈਸ ਸਿਲੰਡਰ ਗੈਸ ਸਿਲੰਡਰ ਚੱਲਦਾ ਰਿਹਾ ਕੁਝ ਕੁਝ ਸਮਾਂ ਚੱਲਦਾ ਰਿਹਾ ਉਪਕਰਨ ਉਪਰੰਤ ਹੁਣ ਤਾਂ ਜੀ ਉਹ ਛੱਡੋ ਹੁਣ ਤਾਂ ਗੈਸ ਪਾਈਪ ਲਾਈਨ ਹੀ ਰਸੋਈ ਤੱਕ ਪਹੁੰਚ ਗਈ ਆ ਡਾਇਰੈਕਟ ਅਤੇ ਪਹਿਲਾਂ ਕੋਈ ਗਰਮੀ ਵੀ ਝੱਲਣੀ ਪੈਂਦੀ ਸੀ ਹੁਣ ਰਸੋਈਆਂ ਦੇ ਵਿੱਚ ਪੱਖੇ ਵੀ ਲੱਗ ਗਏ ਆ ਉੱਪਰ ਪੱਖੇ ਲੱਗੇ ਆ ਅਤੇ ਰਸੋਈ ਦਾ ਜਿਹੜਾ ਕਿਤੇ ਟੈਪਰੇਚਰ ਜੇ ਅਗਰ ਵਧਦਾ ਆ ਤਾਂ ਉਸਨੂੰ ਕੱਢਣ ਲਈ ਅਗਜਾਸਟ ਫੈਨ ਲੱਗੇ ਹੋਏ ਆ ਧੂੰਆਂ ਵਗੈਰਾ ਕੱਢਣ ਲਈ ਚਿਮਨੀਆਂ ਲੱਗ ਗਈਆਂ ਪੂਰੀਆਂ ਸਿਲੰਡਰ ਦੇ ਉੱਪਰ ਸਿਲੰਡਰ ਦੇ ਉੱਪਰ ਇੱਕ ਚਿਮਨੀ ਜਿਹੀ ਚਿਮਨੀ ਰਾਦ ਹੋ ਗਈ ਉਹ ਲੱਗ ਗਈ ਵੀ ਚਾ ਅੰਦਰ ਧੂੰਆਂ ਹੋਵੇ ਹੀ ਨਾ ਕੋਈ ਸਮੈਲ ਹੋਵੇ ਹੀ ਨਾ ਘਿਉ ਦੀ ਵੀ ਚੱਲ ਬਾਹਰ ਅਤੇ ਇਸ ਕਰਕੇ ਪਹਿਲਾਂ ਨਾਲੋਂ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਅੱਜ ਔਰ ਪਹਿਲਾਂ ਵਾਲੇ ਸਮੇਂ 'ਚ